ਪਿਛਲੇ ਦਿਨੀ ਮੈਂ ਇੱਕ ਕਲਾ ਪ੍ਰਦਰਸ਼ਨੀ ਵਿੱਚ ਗਈ ਜਿਸ ਵਿੱਚ ਹੱਥਾਂ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਦੀ ਪ੍ਰਦਰਸ਼ਨੀ ਕੀਤੀ ਜਾ ਰਹੀ ਸੀ ਜਿਸ ਵਿੱਚ ਹੱਥਾਂ ਦੁਆਰਾ ਬਣਾਏ ਗਏ ਬੈਗ ਸੂਟਾਂ 'ਤੇ ਕੀਤੀ ਗਈ ਕਢਾਈ ਸੂਟਾਂ 'ਤੇ ਕੀਤਾ ਗਿਆ ਪੇਂਟ ਆਦਿ ਹੋਰ ਬਹੁਤ ਸਾਰੀਆਂ ਹੱਥਾਂ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਦੀ ਪ੍ਰਦਰਸ਼ਨੀ ਕੀਤੀ ਗਈ ਜੋ ਕਿ ਬਹੁਤ ਸੋਹਣੀਆਂ ਦਿਖਾਈ ਦੇ ਰਹੀਆਂ ਸਨ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਆਪ ਹੱਥਾਂ ਦੁਆਰਾ ਬੈਗ ਤਿਆਰ ਕੀਤੇ ਸੂਟਾਂ 'ਤੇ ਕਢਾਈ ਕੀਤੀ ਅਤੇ ਸੂਟ 'ਤੇ ਪੇਂਟ ਕੀਤਾ ਅੱਜ ਕੱਲ੍ਹ ਜ਼ਿਆਦਾ ਘਰ ਜ਼ਿਆਦਾਤਰ ਸੂਟ 'ਤੇ ਹੱਥ ਦੀ ਕਢਾਈ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਉਹ ਬਹੁਤ ਵਧੀਆ ਅਤੇ ਸੁੰਦਰ ਦਿਖਾਈ ਦਿੰਦੀ ਹੈ ਅਤੇ ਸਾਡੀ ਮਨਪਸੰਦ ਦੀ ਚੀਜ਼ ਬਣਦੀ ਹੈ ਸੂਟਾਂ 'ਤੇ ਕਢਾਈ ਮਸ਼ੀਨੀ ਕਢਾਈ ਜ਼ਿਆਦਾ ਸਾਫ ਨਹੀਂ ਆਉਂਦੀ ਹੱਥ ਦੀ ਕਢਾਈ ਬਹੁਤ ਸਾਫ ਅਤੇ ਸੁੰਦਰ ਦਿਖਾਈ ਦਿੰਦੀ ਹੈ ਉਸ ਕਲਾ ਪ੍ਰਦਰਸ਼ਨੀ ਤੋਂ ਪ੍ਰਭਾਵਿਤ ਹੋ ਕੇ ਮੈਂ ਸੂਟਾਂ 'ਤੇ ਕਢਾਈ ਪੇਂਟ ਬੈਗ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ